ਹਾਂਜੀ ਨਮਸਤੇ ਮੈਮ ਠੀਕ ਹੈ ਠੀਕ ਠੀਕ ਠੀਕ ਮੈਮ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਤੁਸੀਂ ਆਪਣੇ ਸਕੂਲ ਪ੍ਰੋਗਰਾਮ ਕਰਵਾਇਆ ਕੋਈ ਸੱਭਿਆਚਾਰ ਦੇ ਰਿਲੇਟਡ ਅੱਛਾ ਜੀ ਅੱਛਾ ਜੀ ਇਸ ਵਿਚ ਕਿਹੜੀ ਕਿਹੜੀ ਆਈਟਮ ਰੱਖੀ ਤੁਸੀਂ ਹਾਂਜੀ

ਠੀਕ ਹੈ ਜੀ ਠੀਕ ਹੈ ਅੱਛਾ ਜੀ ਅੱਛਾ ਅੱਛਾ ਜਿਸ ਤਰ੍ਹਾਂ ਤੁਸੀਂ ਪੰਜਾਬੀ ਭੰਗੜਾ ਜਾਂ ਗਿੱਧਾ ਕਰਵਾਇਆ ਉਹਦੇ ਵਿੱਚ ਫਿਰ ਸੰਮੀ ਵਗੈਰਾ ਵੀ ਰੱਖੀ ਜਾਂ ਸਿਰਫ ਤੁਸੀਂ ਫਿਰ ਉਹ ਵੀ ਰੱਖਿਆ ਮਤਲਬ ਕਿ ਸਿੰਪਲ ਬੋਲੀਆਂ ਵਗੈਰਾ ਹੀ ਰੱਖੀਆਂ ਸੀਗੀਆਂ ਅੱਛਾ ਜੀ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਫਿਰ ਬਾਅਦ ਵਿੱਚ ਤੁਹਾਡਾ ਮਤਲਬ ਪ੍ਰਾਈਸ ਡਿਸਟ੍ਰੀਬਿਊਸ਼ਨ ਵੀ ਰਹੀ ਹੋਏਗੀ ਹੈ ਨਾ ਜੋ ਵੀ ਕੀਤ ਕਰਵਾਇਆ ਗਿਆ ਹੈਗਾ ਹੈ ਨਾ ਜਿਹੜੇ ਫਸਟ ਰਨਰ ਅਪ ਸੈਕਿੰਡ ਰਨਰ ਅਪ ਰਹੇ ਹੋਣਗੇ ਅੱਛਾ ਮੈਮ ਐਕਚੁਲੀ ਨਾ ਅਸੀਂ ਵੀ ਇਹੋ ਜਿਹਾ ਇਕ ਪ੍ਰੋਗਰਾਮ ਕਰਵਾਉਣਾ ਆਪਣੇ ਸਕੂਲ ਤਾਂ ਥੋੜ੍ਹਾ ਜਿਹਾ ਤੁਹਾਡੇ ਕੋਲੋਂ ਅਸੀਂ ਥੋੜ੍ਹੀ ਲੈਣਾ ਚਾਹੁੰਦੇ ਸੀ ਗਾਈਡਲਾਈਨ ਕਿ ਤੁਸੀਂ ਜਿਸ ਤਰ੍ਹਾਂ ਫਸਟ ਆਈਟਮ ਕਿਹੜੀ ਰੱਖੀ ਸੈਕਿੰਡ ਆਈਟਮ ਕਿਹੜੀ ਰੱਖੀ ਔਰ ਬੱਚਿਆਂ ਦੀ ਮੋਟੀਵੇਸ਼ਨ ਨੂੰ ਉਹਨਾਂ ਨੂੰ ਕਰਨ ਲਈ ਤੇ ਪ੍ਰਾਈਸ ਡਿਸਟ੍ਰੀਬਿਊਸ਼ਨ 'ਚ ਕੀ ਕੀ ਦਿੱਤਾ ਉਹਨਾਂ ਨੂੰ ਤੁਸੀਂ ਅੱਛਾ ਜੀ ਅੱਛਾ ਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਵਧੀਆ ਰਹਿੰਦਾ ਵਿਚ ਰੱਖਿਆ ਹੋਇਆ ਵਧੀਆ ਰਹਿੰਦਾ ਜਾਂ ਲਾਸਟ 'ਚ ਭੰਗੜਾ ਰੱਖਿਆ ਰਹੇ ਤਾਂ ਹੀ ਬੱਚੇ ਬੜਾ ਮਤਲਬ ਰਹਿੰਦੇ ਐਕਸਾਈਟਿਡ ਕਿ ਲਾਸਟ 'ਚ ਅਸੀਂ ਉੱਠਣਾ ਨਹੀਂ ਉੱਨੀ ਦੇਰ ਤੱਕ ਜਿੰਨੀ ਦੇਰ ਤੱਕ ਭੰਗੜਾ ਨਾ ਹੋ ਜੇ ਹੈ ਨਾ ਹਾਂਜੀ

ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਮੈਮ ਠੀਕ ਹੈ ਮੈਮ ਅਗਰ ਅਸੀਂ ਪੰਦਰਾਂ ਅਗਸਤ ਨੂੰ ਪ੍ਰੋਗਰਾਮ ਕਰਵਾਵਾਂਗੇ ਤਾਂ ਜ਼ਰੂਰ ਤੁਹਾਨੂੰ ਕਾਲ ਕਰ ਕੇ ਤੁਹਾਡੇ ਕੋਲੋਂ ਥੋੜ੍ਹਾ ਜਿਹਾ ਪੁੱਛਿਆ ਜਾਏਗਾ ਕਿ ਹਾਂਜੀ ਮੈਮ ਦੱਸ ਦਿਓ ਸਾਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਕੀਤਾ ਹੈ ਨਾ ਠੀਕ ਹੈ ਮੈਮ ਤਾਂ ਥੈਂਕਸ ਟੂ ਨਾਈਸ ਟੋਕ ਟੂ ਯੂ ਥੈਂਕਯੂ ਮੈਮ ਓਕੇ ਜੀ ਓਕੇ ਓਕੇ